ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਪੰਜਾਬੀ ਸੂਟ ਠੀਕ ਹੈ ਜੀ ਹਾਂਜੀ ਤੁਸੀਂ ਦੱਸੋ ਵੀ ਮਤਲਬ ਕੱਪੜਾ ਤੁਸੀਂ ਆਪ ਲੈ ਕੇ ਆਉਗੇ ਜਾਂ ਤੁਸੀਂ ਇੱਥੋਂ ਹੀ ਲੈਣਾ ਹੈ ਹਾਂਜੀ ਹਾਂਜੀ ਬਿਲਕੁਲ ਹਾਂਜੀ ਹਾਂਜੀ ਸਟੱਫ ਦੋ ਤਿੰਨ ਹੈਗੇ ਨੇ ਉਹ ਤੁਸੀਂ ਫਿਰ ਆ ਕੇ ਜਿਵੇਂ ਪਸੰਦ ਕਰ ਲਿਆ ਜਿਹੜਾ ਤੁਹਾਨੂੰ ਪਸੰਦ ਹੈ ਤਾਂ ਹਾਂਜੀ ਹਾਂਜੀ ਉਹ ਤੁਸੀਂ ਵੇਖ ਲਿਓ ਹੁਣ ਕੀ ਤੁਸੀਂ ਉਹਦੇ 'ਤੇ ਮਤਲਬ ਵਰਕ ਵਗੈਰਾ ਕਰਵਾ ਕੇ ਤਿਆਰ ਕਰਵਾਉਣਾ ਹੈ ਜਾਂ ਵੈਸੇ ਗੋਟਾ ਗੁਟਾ ਲਗਵਾ ਕੇ ਤਿਆਰ ਕਰਉਣਾ ਹੈ ਅਤੇ ਹੈਂਡ ਵਰਕ ਚਾਹੀਦਾ ਜਾਂ ਤੁਹਾਨੂੰ ਮਸ਼ੀਨੀ ਵਰਕ ਚਾਹੀਦਾ ਹਾਂ ਉਹ ਤੁਸੀਂ ਫਿਰ ਮੈਂ ਤੁਹਾਨੂੰ ਹਾਂਜੀ ਹਾਂਜੀ ਤੁਸੀਂ ਉਹ ਮੈਂ ਤੁਹਾਨੂੰ ਡਿਜ਼ਾਇਨ ਵਗੈਰਾ ਦਿਖਾ ਦਵਾਂਗੀ ਤੁਸੀਂ ਪਸੰਦ ਕਰ ਲਿਆ ਜੇ ਫਿਰ ਆਪਾਂ ਉਵੇਂ ਉਵੇਂ ਦਾ ਵਰਕ ਕਰਵਾ ਲਵਾਂਗੇ ਉਹ ਤੁਹਾਡੇ 'ਤੇ ਡਿਪੈਂਡ ਹੈ ਵੈਸੇ ਤਾਂ ਜਿਵੇਂ ਹੁਣ ਅੱਜ ਕੱਲ੍ਹ ਏ ਸ਼ੇਪ ਦਾ ਘੇਰਾ ਚੱਲਦਾ ਹੈ ਠੀਕ ਹੈ ਹਾਂਜੀ ਹਾਂਜੀ ਘੇਰਾ ਘੇਰਾ ਹੀ ਹਾਂਜੀ ਉਹ ਵੀ ਚੱਲਦਾ ਕਲੀਆਂ ਕੁਲੀਆਂ ਵਾਲਾ ਵੀ ਹਾਂਜੀ ਹਾਂਜੀ ਬਾਕੀ ਦੁਪੱਟਾ ਨਾਲ ਤਿਆਰ ਹੋ ਜਾਏਗਾ ਉਵੇਂ ਹਾਂਜੀ ਹਾਂਜੀ ਇਹ ਜਿਵੇਂ ਵਰਕ ਗੋਲਡਨ 'ਚ ਹੋਣਾ ਚਾਹੀਦਾ ਜਾਂ ਸਿਲਵਰ 'ਚ ਹਾਂਜੀ ਠੀਕ ਹੈ ਠੀਕ ਹੈ ਹਾਂਜੀ ਬੋਟਮ ਦੇ ਵੀ ਪਹੁੰਚਿਆਂ 'ਤੇ ਹਾਂਜੀ ਬਾਕੀ ਨਾਲ ਉਵੇਂ ਦੁਪੱਟੇ ਦੇ ਚਾਰੇ ਘੇਰਿਆਂ 'ਤੇ ਹੋ ਜਾਏਗਾ ਹਾਂਜੀ ਹਾਂਜੀ ਨਹੀਂ ਸੰਡੇ ਬੰਦ ਹੁੰਦਾ ਹੈ ਬਾਕੀ ਤੁਸੀਂ ਜਦੋਂ ਆਉਗੇ ਪਹਿਲਾਂ ਫੋਨ ਕਰ ਲਿਓ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਉਹ ਕੋਈ ਨਹੀਂ ਤੁਸੀਂ ਆਉਗੇ ਸ਼ੋਪ 'ਤੇ ਫਿਰ ਆਪਾਂ ਬੈਠ ਕੇ ਗੱਲ ਕਰ ਲਵਾਂਗੇ ਨਹੀਂ ਨਹੀਂ ਤੁਹਾਨੂੰ ਪੂਰਾ ਸਜਾਵਾਂਗੇ ਤੁਹਾਡੇ ਵਿਆਹ 'ਤੇ ਠੀਕ ਹੈ ਜੀ ਹਾਂਜੀ ਓਕੇ ਜੀ